ਮੇਰੀ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਅੱਜ ਇਸ ਕੋਲੇਜ ਦੇ ਵਿੱਚ ਖਾਲਸਾ ਕੋਲੇਜ ਪਟਿਆਲਾ ਦੇ ਵਿੱਚ ਜਿਹੜਾ ਇੱਕ ਐਜ ਏ ਅਸਿਸਟੈਂਟ ਪ੍ਰੋਫੈਸਰ ਇਨ ਜੋਗ੍ਰਾਫੀ ਜਿਹੜਾ ਹੈ ਕੰਮ ਕਰ ਰਿਹਾ ਇਸ ਮੁਕਾਮ 'ਤੇ ਪਹੁੰਚਣਾ ਮੇਰੇ ਲਈ ਕੋਈ ਛੋਟਾ ਨਹੀਂ ਸੀਗਾ ਇਸ ਮੁਕਾਮ 'ਤੇ ਪਹੁੰਚਣ ਲਈ ਮੈਂ ਬੜੀ ਮਿਹਨਤ ਕੀਤੀ ਆ ਬੜੇ ਹੋਰ ਇੰਸਚੀਟਿਊਸ਼ਨ ਦੇ ਵਿੱਚ ਸਕੂਲਾਂ ਕੋਲਜ ਪਹਿਲਾਂ ਪੜ੍ਹਾ ਕੇ ਆਇਆ ਗਾ ਉਹ ਛੋਟੇ ਸੀਗੇ ਥੋੜ੍ਹੇ ਜਿਹੇ ਉੱਥੋਂ ਬੜੇ ਕਾਫੀ ਸਾਨੂੰ ਫੇਲਰਸ ਮਿਲੀਆਂ ਨੇ ਪਹਿਲਾਂ ਬੋਲਣਾ ਨਹੀਂ ਆਉਂਦਾ ਸੀਗਾ ਡੈਸ਼ 'ਤੇ ਕਿਵੇਂ ਬੋਲਾਂ ਬਟ ਹੌਲੀ ਹੌਲੀ ਜਿਹੜੀ ਹੈਗੀ ਸਕਸੈਸ ਨੂੰ ਪਹੁੰਚਦਾ ਪਹੁੰਚਦਾ ਮੈਂ ਇਸ ਮੁਕਾਮ 'ਤੇ ਪਹੁੰਚਿਆ ਅਤੇ ਇਸ ਮੁਕਾਮ 'ਤੇ ਪਹੁੰਚ ਕੇ ਮੈਨੂੰ ਬੜਾ ਹੀ ਇੱਕ ਫਖਰ ਜਿਹਾ ਮਹਿਸੂਸ ਹੁੰਦਾ ਵੀ ਹਾਂ ਜਿਹੜਾ ਹੈ ਮੈਂ ਇੱਕ ਕੋਲੇਜ ਦੇ ਵਿੱਚ ਇੱਕ ਜਿਹੜਾ ਹੈ ਰੈਪੂਟੇਸ਼ਨਲ ਕੋਲੇਜ ਹੈ ਪੰਜਾਬ ਲੈਵਲ ਦਾ ਇੰਡੀਆ ਇੰਡੀਅਨ ਲੈਵਲ ਦਾ ਖਾਲਸਾ ਕੋਲੇਜ ਪਟਿਆਲਾ ਉਸ ਕੋਲੇਜ ਦੇ ਵਿੱਚ ਜਿਹੜਾ ਹੈ ਮੈਂ ਇੱਕ ਐਜ ਏ ਅਸਿਸਟੈਂਟ ਪ੍ਰੋਫੈਸਰ ਜਿਹੜਾ ਹੈ ਵਰਕ ਕਰ ਰਿਹਾ ਮਤਲਬ ਪਿਛਲੇ ਕਈ ਸਾਲਾਂ ਤੋਂ ਜਿਹੜਾ ਮੈਂ ਇੱਥੇ ਇਹਦਾ ਕੋਲੇਜ ਦਾ ਹਿੱਸਾ ਹਾਂ ਅਤੇ ਇਹ ਵੇਲੇ ਬੜੀ ਹੀ ਮਾਣ ਵਾਲੀ ਗੱਲ ਹੈ ਮੇਰੇ ਲਈ